ਲਿਖਤਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਵੱਖ ਵੱਖ ਸ਼ੈਲੀਆਂ ਕਵਿਤਾਵਾਂ ਗਲਪ ਨਾਟਕ ਲਿਖੇ ਜਾਂਦੇ ਹਨ ਕਵਿਤਾਵਾਂ ਲੋਕਾਂ ਦੀਆਂ ਮਨੋ ਭਾਵਨਾਵਾਂ ਅਤੇ ਉਹਨਾਂ ਦੇ ਦਿਲਾਂ ਦੀਆਂ ਗੱਲਾਂ ਨੂੰ ਲੋਕਾਂ ਤੱਕ ਪਹੁੰਚਾਉਂਦੀ ਹੈ ਨਾਟਕਾਂ ਵਿੱਚ ਬਹੁਤ ਸਾਰੇ ਪਾਤਰਾਂ ਦਾ ਜ਼ਿਕਰ ਹੁੰਦਾ ਹੈ ਜਿਸ ਵਿੱਚ ਕਿਸੇ ਦੇ ਪਰਿਵਾਰਕ ਸਮਾਜਿਕ ਅਤੇ ਦੁਨੀਆ ਦੀਆਂ ਗੱਲਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਅਸੀਂ ਵੇਖਦੇ ਹਾਂ ਕਿ ਇਹਨਾਂ ਨੂੰ ਲਿਖਣ ਲਈ ਸਮਾਂ ਵੀ ਚਾਹੀਦਾ ਹੈ ਅਤੇ ਮਾਹੌਲ ਵੀ ਇਸ ਵਿੱਚ ਬਹੁਤ ਸਾਰੇ ਲੇਖਕਾਂ ਨੇ ਕੰਮ ਕੀਤਾ ਹੈ ਜਿਵੇਂ ਕਿ ਸੁਰਜੀਤ ਪਾਤਰ ਉਹਨਾਂ ਨੇ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਹਨ ਜਿਸ ਵਿੱਚ ਉਹਨਾਂ ਨੇ ਮਾਂ ਬਾਪ ਪਿੰਡਾਂ ਆਜ਼ਾਦੀ ਵਿਛੋੜੇ ਦੀ ਗੱਲ ਕੀਤੀ ਹੈ ਇਹਨਾਂ ਸ਼ੈਲੀਆਂ ਵਿੱਚ ਉਹਨਾਂ ਦਾ ਕੰਮ ਬਹੁਤ ਹੀ ਸਾਫ ਅਤੇ ਸੁਥਰਾ ਰਿਹਾ ਹੈ ਸੁਰਜੀਤ ਪਾਤਰ ਦੁਆਰਾ ਬਹੁਤ ਸਾਰੀਆਂ ਕਵਿਤਾਵਾਂ ਨੂੰ ਲੋਕਾਂ ਦੇ ਮਨੋਭਾਵਾਂ ਤੱਕ ਪਹੁੰਚਾਇਆ ਗਿਆ ਹੈ ਕਵਿਤਾਵਾਂ ਨਾਟਕ ਗਲਪ ਇਹਨਾਂ ਰਾਹੀਂ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਉਹਨਾਂ ਤੋਂ ਕੰਮ ਕਰਵਾਉਣ ਦੀ ਇੱਛਾ ਨੂੰ ਪ੍ਰਗਟ ਕੀਤਾ ਜਾਂਦਾ ਹੈ ਸਾਡੇ ਦੁਆਰਾ ਬਹੁਤ ਸਾਰੇ ਨਾਟਕ ਕਵਿਤਾਵਾਂ ਗਲਪ ਲਿਖੇ ਜਾਂਦੇ ਹਨ ਜਿਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣ ਲਈ ਸਾਨੂੰ ਮਿਹਨਤ ਕਰਨੀ ਪੈਂਦੀ ਹੈ ਕਵਿਤਾਵਾਂ ਮਨੁੱਖ ਦੇ ਮਨੋ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਨਾਟਕਾਂ ਵਿੱਚ ਪਾਤਰਾਂ ਦੁਆਰਾ ਹਰ ਇੱਕ ਪਾਤਰ ਨੂੰ ਬੜੇ ਹੀ ਸੁਚੱਜੇ ਰੂਪ ਨਾਲ ਦਰਸਾਇਆ ਜਾਂਦਾ ਹੈ ਜਿਸ ਵਿੱਚ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਦੁਨੀਆ ਦੀਆਂ ਸਮਾਜਿਕ ਤੌਰ 'ਤੇ ਸਾਰੀਆਂ ਪ੍ਰਸਿੱਧ ਭਾਵਨਾਵਾਂ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਇੱਥੇ ਹੀ ਮੈਂ ਦੱਸਦੀ ਹਾਂ ਕਿ ਆਪਣੀ ਲਿਖਤ ਨੂੰ ਪ੍ਰਭਾਵਿਤ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਮਿਲਦੀਆਂ ਹਨ ਧੰਨਵਾਦ